ਮੋਹਾਲੀ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੁੱਖ ਸਰੋਤ ਬਹੁਤ ਹਨ ਜਿਵੇਂ ਕਿ ਇੰਡਸਟਰੀ ਹੋ ਗਈ ਹੈ ਅਤੇ ਕੰਪਨੀਆਂ ਹੋ ਗਈਆਂ ਨੇ ਅਤੇ ਬਾਕੀ ਹੋਰ ਵੀ ਪ੍ਰਾਈਵੇਟ ਅਦਾਰੇ ਬਹੁਤ ਹਨ ਇਹ ਕਿ ਸਰਕਾਰੀ ਨੌਕਰੀਆਂ ਦੀ ਇਹ ਹੈ ਵੀ ਸਰਕਾਰੀ ਨੌਕਰੀ ਪੱਕੀ ਹੁੰਦੀ ਹੈ ਅਤੇ ਪ੍ਰਾਈਵੇਟ ਨੌਕਰੀ ਦੇ ਵਿੱਚ ਤਨਖਾਹ ਜ਼ਿਆਦਾ ਹੁੰਦੀ ਹੈ ਲੇਕਿਨ ਉਹਦੀ ਸਕੋਰਟੀ ਕੋਈ ਨਹੀਂ ਹੁੰਦੀ ਪੱਕੀ ਨਹੀਂ ਹੁੰਦੀ ਉਹ ਉਹ ਤੁਹਾਨੂੰ ਕਦੋਂ ਵੀ ਜਦੋਂ ਮਰਜ਼ੀ ਕੱਢ ਸਕਦੇ ਹੈ ਅਤੇ ਸਾਡੇ ਜ਼ਿਲ੍ਹੇ ਵਿੱਚ ਬੇਰੁਜ਼ਗਾਰੀ ਬਹੁਤ ਫੈਲੀ ਹੋਈ ਹੈ ਇਸ ਦੇ ਸੁਝਾਅ ਇਹੀ ਹੈ ਕੁਛ ਸਰਕਾਰ ਵੀ ਮਦਦ ਕਰ ਸਕਦੀ ਹੈ ਇਸ ਦੇ ਵਿੱਚ ਕੁਛ ਬੰਦਾ ਥੋੜ੍ਹੀ ਜਿਹੀ ਆਪ ਵੀ ਹਿੰਮਤ ਕਰ ਸਕਦਾ ਹੈ ਕਿਸੀ ਕੰਪਨੀ 'ਚ ਮਤਲਬ ਕਿ ਵੇਖ ਕਿਸੀ ਫੈਕਟਰੀ 'ਚ ਲੱਗ ਜਾਵੇ ਅਤੇ ਹੋਰ ਵੀ ਆਪਣਾ ਕੰਮ ਕਰ ਸਕਦਾ ਹੈ ਇਸ ਸੇ ਬੇਰੁਜ਼ਗਾਰੀ ਦਾ ਹੱਲ ਹੋ ਸਕਦਾ ਹੈ